ਮੈਂ ਪਿਛਲੇ ਹਫ਼ਤੇ ਇੱਕ ਔਨਲਾਈਨ ਸ਼ੋਪਿੰਗ ਵੈਬਸਾਈਟ ਤੋਂ ਕੈਮਰਾ ਜਾਂ ਮੋਬਾਇਲ ਤੋਂ ਵੀਡੀਓ ਬਣਾਉਣ ਦੇ ਲਈ ਇੱਕ ਟਰਾਈਪੋਡ ਖਰੀਦਿਆ ਸੀ ਅਤੇ ਇਹ ਟਰਾਈਪੋਡ ਇੱਕ ਟੈਲੀਸਕੋਪਿਕ ਆਮ ਟਾਈਪ ਟਰਾਈਪੋਡ ਹੈ ਜਿਸ ਦੇ ਵਿੱਚੋਂ ਜੋ ਇਸ ਦੀਆਂ ਆਮਜ਼ ਹਨ ਉਹਨਾਂ ਨੂੰ ਅਸੀਂ ਬਾਹਰ ਕੱਢ ਕੇ ਟਰਾਈਪੋਡ ਦੀ ਜੋ ਲੰਬਾਈ ਹੈ ਉਸ ਨੂੰ ਵਧਾ ਜਾਂ ਘਟਾ ਸਕਦੇ ਹਾਂ ਪਰ ਇਸ ਟਰਾਈਪੋਡ ਨੂੰ ਖ਼ਰੀਦਣ ਤੋਂ ਬਾਅਦ ਮੈਨੂੰ ਬਹੁਤ ਸਾਰੀਆਂ ਖਾਮੀਆਂ ਇਸ ਟਰਾਈਪੋਡ ਦੇ ਵਿੱਚ ਨਜ਼ਰ ਆਈਆਂ ਤਾਂ ਪਹਿਲੀ ਖਾਮੀ ਜੋ ਹੈ ਉਹ ਇਹ ਹੈ ਕਿ ਜਿਹੜੀ ਹੋਲਡਰ ਅਟੈਚਮੈਂਟ ਹੈ ਜਿਸ ਦੇ ਵਿੱਚ ਅਸੀਂ ਕੈਮਰਾ ਜਾਂ ਮੋਬਾਈਲ ਫੋਨ ਨੂੰ ਹੋਲਡ ਕਰਦੇ ਹਾਂ ਜਾਂ ਪਕੜਦੇ ਹਾਂ ਉਹ ਟਰਾਈਪੋਡ ਦੇ ਨਾਲ ਚੰਗੀ ਤਰ੍ਹਾਂ ਅਟੈਚ ਨਹੀਂ ਹੁੰਦੀ ਉਹ ਥੋੜ੍ਹੀ ਢਿੱਲੀ ਰਹਿ ਰਹਿ ਜਾਂਦੀ ਹੈ ਜਿਸ ਦੇ ਕਰਕੇ ਕੈਮਰਾ ਜਾਂ ਮੋਬਾਈਲ ਫੋਨ ਗਿਰਨ ਦਾ ਖ਼ਤਰਾ ਹੈ ਇਸ ਤੋਂ ਬਾਅਦ ਦੂਜੀ ਵੱਡੀ ਖਾਮੀ ਜੋ ਮੈਨੂੰ ਇਸ ਦੇ ਵਿੱਚ ਨਜ਼ਰ ਆਈ ਉਹ ਇਹ ਹੈ ਕਿ ਜਿਹੜੀਆਂ ਟੈਲੀਸਕੋਪਿਕ ਆਮਜ਼ ਹਨ ਉਹਨਾਂ ਨੂੰ ਜਦੋਂ ਅਸੀਂ ਪੂਰੀ ਲੰਬਾਈ ਦੇ ਵਿੱਚ ਬਾਹਰ ਕੱਢ ਦਿੰਦੇ ਹਾਂ ਅਤੇ ਉਸ ਤੋਂ ਬਾਅਦ ਕੈਮਰਾ ਜਾਂ ਮੋਬਾਈਲ ਫੋਨ ਇਸ ਦੇ ਉੱਤੇ ਅਟੈਚ ਕਰ ਦਿੰਦੇ ਹਾਂ ਤਾਂ ਕੈਮਰਾ ਜਾਂ ਮੋਬਾਈਲ ਦੇ ਵਜ਼ਨ ਦੇ ਨਾਲ ਇਹ ਜਿਹੜੀਆਂ ਆਮਜ਼ ਹਨ ਉਹ ਵਾਪਸ ਅੰਦਰ ਜਾਣੀਆਂ ਸ਼ੁਰੂ ਹੋ ਜਾਂਦੀ ਹਨ ਜਿਸ ਦੇ ਕਰਕੇ ਇਹ ਚੰਗੀ ਤਰਾਂ ਜੋ ਹੋਲਡਰ ਹੈ ਉਹ ਕੈਮਰਾ ਜਾਂ ਮੋਬਾਈਲ ਨੂੰ ਬੈਲੰਸ ਨਹੀਂ ਕਰ ਪਾਉਂਦਾ ਤੋ ਇਹ ਕੁਛ ਵੱਡੀਆਂ ਖਾਮੀਆਂ ਸਨ ਜੋ ਮੈਨੂੰ ਇਸ ਟਰਾਈਪੋਡ ਦੇ ਵਿੱਚ ਨਜ਼ਰ ਆਈਆਂ